ਹੈਲੋ ਨਮਸ਼ਕਾਰ ਹਾਂਜੀ ਕੀ ਨਾਮ ਐ ਤੁਹਾਡਾ ਠੀਕ ਹੈ ਹਾਂਜੀ ਦੱਸੋ ਮੈਂ ਤੁਹਾਡੀ ਕੀ ਸਹਾਇਤਾ ਕਰ ਸਕਦੀ ਆਂ ਠੀਕ ਹੈ ਕਿਸ ਸਾਈਡ ਹੈ ਠੀਕ ਹੈ ਸਾਰੀ ਜਮੀਨ ਇੱਕੋਂ ਹੀ ਸਾਈਡ ਹੈ ਠੀਕ ਹੈ ਤੇ ਤੁਸੀਂ ਕਿਸ ਤਰ੍ਹਾਂ ਦੀ ਕਿਸ ਕਿਹੜੀ ਕਿਹੜੀ ਫ਼ਸਲ ਬੀਜਣੀ ਚਾਹੰਦੇ ਹੋ ਤੇ ਜਿੱਥੇ ਤੁਹਾਡੀ ਜਮੀਨ ਹੈ ਉਸ ਦੇ ਨਾਲ ਪਾਣੀ ਦੀ ਫਸਿਲਟੀ ਜਾਂ ਉਨ੍ਹਾਂ ਦਾ ਦਾ ਇਲਾਕਾ ਕਿਸ ਤਰ੍ਹਾਂ ਦਾ ਹੈ ਠੀਕ ਹੈ ਹੋਰ ਕੋਈ ਓਥੇ ਕੋਈ ਪ੍ਰੋਬਲਮ ਵਾਲੀ ਤਾਂ ਦਿੱਕਤ ਨਈਂ ਹੈਗੀ ਕੋਈ ਜਾਨਵਰਾਂ ਦਾ ਆਨਾ ਜਾਨਾ ਜਾਂ ਕੁਛ ਵੀ ਠੀਕ ਹੈ ਤੁਸੀਂ ਕਿਹੜੀ ਕਿਹੜੀ ਫ਼ਸਲ ਬੀਜਣਾ ਚਾਹੰਦੇ ਹੋ ਕੀ ਤੁਸੀਂ ਹੋਰ ਤੰਤਰਾਂ ਦੀ ਅਨਾਜ ਨੇ ਆਪਣੇ ਬਾਜਰਾ ਮੱਕੀ ਰਾਗੀ ਐਸ ਤਰ੍ਹਾਂ ਦੀਆਂ ਫ਼ਸਲਾਂ ਵੀ ਨਾਲ ਟਰਾਈ ਕਰੋ ਜਿਨ੍ਹਾਂ ਨਾਲ ਕੀ ਤੁਹਾਡੀ ਖੇਤੀ ਨੂੰ ਜਿਆਦਾ ਉਪਜਾਊ ਮਿੱਟੀ ਅਗਰ ਮਿੱਟੀ ਦੀ ਕੁਆਲਟੀ ਅੱਛੀ ਹੈ ਤਾਂ ਉਹਨੂੰ ਚੈੱਕ ਕਰਵਾ ਕੇ ਉਸ ਤਰ੍ਹਾਂ ਦੀਆਂ ਫ਼ਸਲਾਂ ਵੀ ਟਰਾਈ ਕਰੋ ਤਾਂ ਕੀ ਤੁਹਾਨੂੰ ਨਮੀ ਚੀਜ ਦੇ ਆਸ ਪਾਸ ਦੇ ਇਲਾਕਿਆਂ ਨੂੰ ਮਿਲ ਸਕੇ ਤੁਸੀਂ ਬੀਜ ਸਾਰੇ ਤਰ੍ਹਾਂ ਦੇ ਨੇ ਅੱਛੀ ਕੁਆਲਟੀ ਦੇ ਮਿਲਣਗੇ

ਤੁਸੀਂ ਟੋਟਲ ਕਿੰਨੇ ਕਿੱਲੇ ਦੀ ਜਮੀਨ ਦੱਸੀ ਸੋਲ੍ਹਾਂ ਕਿੱਲੇ ਵਿੱਚ ਦੋ ਕਿੱਲੇ ਸਰੋਂ ਦਾ ਤਿੰਨ ਜਾਂ ਚਾਰ ਕਿੱਲੇ ਤੁਸੀਂ ਆਪਨੀ ਕਣਕ ਨੂੰ ਦੇ ਸਕਦੇ ਓ ਫਿਰ ਉਨ ਦੇ ਵਿੱਚ ਤੁਸੀਂ ਜਮੀਨ ਦੀ ਕੁਆਲਟੀ ਨੂੰ ਜਾਂ ਮਿੱਟੀ ਦੀ ਕੁਆਲਟੀ ਚੈੱਕ ਕਰਾ ਕੇ ਉਸ ਸਾਬ ਨਾਲ ਤੁਸੀਂ ਵਿੱਚ ਰਾਗੀ ਮੱਕੀ ਜਾਂ ਬਾਜਰਾ ਕਿਸੇ ਵੀ ਤਰ੍ਹਾਂ ਦੀ ਦੀ ਫ਼ਸਲ ਨੂੰ ਅੱਗੇ ਲੈ ਸਕਦੇ ਓ ਤਾਂ ਕੀ ਉਹ ਧਾਨੂੰ ਨਮੀ ਚੀਜ ਮਿਲੇ ਤੇ ਉਸ ਮੱਕੀ ਹਾਂਜੀ ਬਾਕੀ ਉਸ ਤੋਂ ਆਸ ਪਾਸ ਦੇ ਇਲਾਕੇ ਨੂੰ ਵੇਖ ਕੇ ਪਾਣੀ ਨੂੰ ਵੀ ਪਾਣੀ ਦੀ ਫਸਿਲਟੀਜ ਦੇ ਹਿਸਾਬ ਨਾਲ ਤੁਸੀਂ ਆਪਣੀ ਚੀਜ 'ਚ ਪੂਰਾ ਕਰ ਸਕਦੇ ਓ ਹਾਂ ਆ ਕੇ ਬਾਕੀ ਤੁਸੀਂ ਆਕੇ ਦਫ਼ਤਰ ਮਿਲੋਗੇ ਫਿਰ ਤੁਹਾਨੂੰ ਸਾਰੀ ਪੂਰੀ ਡਿਟੇਲ ਦਿੱਤੀ ਜਾਏਗੀ ਹਾਂਜੀ ਠੀਕ ਹੈ ਜੀ